ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਭੰਗੜਾ ਪੰਜਾਬ ਦਾ ਮਸ਼ਹੂਰ ਨਾਚ ਹੈ ਹਰ ਖੁਸ਼ੀ ਦੇ ਮੌਕੇ 'ਤੇ ਭੰਗੜਾ ਪਾਇਆ ਜਾਂਦਾ ਹੈਗਾ ਪੰਜਾਬ ਦੇ ਬਾਹਰ ਜਿੱਥੇ ਵੀ ਪੰਜਾਬੀ ਵੱਸਦੇ ਨੇ ਉੱਥੇ ਵੀ ਭੰਗੜੇ ਨੂੰ ਪਾ ਕੇ ਖੁਸ਼ੀ ਜ਼ਾਹਰ ਕੀਤੀ ਜਾਂਦੀ ਹੈ ਜੇ ਭੰਗੜਾ ਨਾ ਪਾਇਆ ਜਾਵੇ ਤਾਂ ਖੁਸ਼ੀ ਜ਼ਾਹਰ ਨਹੀਂ ਕੀਤੀ ਜਾ ਸਕਦੀ ਭੰਗੜਾ ਪੰਜਾਬ ਦੇ ਕਿਸਾਨਾਂ ਵੱਲੋਂ ਫਸਲ ਪੱਕਣ 'ਤੇ ਵੀ ਪਾਇਆ ਜਾਂਦਾ ਵਿਸਾਖੀ ਦੇ ਟਾਈਮ 'ਤੇ ਵਿਸਾਖੀ ਦੇ ਤਿਉਹਾਰ ਨੂੰ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਵਸਾ ਫਸਲਾਂ ਬਾਰੇ ਵੀ ਸਾਡੀ ਫਸਲ ਵਧੀਆ ਹੋ ਗਈ ਪੰਜਾਬ ਦੇ ਵਿੱਚ ਖੁਸ਼ੀ ਨਾਲ ਭੰਗੜਾ ਪਾਇਆ ਜਾਂਦਾ ਹੈ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਵਿਸਾਖੀ ਦੇ ਮੌਕੇ 'ਤੇ ਉਹਨਾਂ ਵੱਲੋਂ ਭੰਗੜਾ ਪਾਏ ਜਾਂਦਾ ਕੋਈ ਖੁਸ਼ੀ ਦਾ ਤਿਉਹਾਰ ਹੋਏ ਵਿਆਹ ਸ਼ਾਦੀਆਂ ਹੋਣ ਲੋਹੜੀ ਹੋਵੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੋਵੇ ਭੰਗੜਾ ਪਾਏ ਬਿਨਾ ਨਾਚ ਭੰਗੜੇ ਨਾਚ ਕੀਤੇ ਬਿਨਾ ਖੁਸ਼ੀ ਨੂੰ ਖੁਸ਼ੀ ਨਹੀਂ ਸਮਝਿਆ ਜਾਂਦਾ ਇਸ ਕਰਕੇ ਭੰਗੜਾ ਪੰਜਾਬ ਦਾ ਮੁੱਖ ਸਰੋਤ ਹੈ ਜਿੱਥੇ ਵੀ ਕੋਈ ਖੁਸ਼ੀ ਹੋਊਗੀ ਉੱਥੇ ਪੰਜਾਬ ਦੇ ਵਿੱਚ ਭੰਗੜਾ ਜ਼ਰੂਰ ਪਾਇਆ ਜਾਊਗਾ ਬੇਟੇ ਦੀ ਸ਼ਾਦੀ ਹੈ ਬੇਟੀ ਸ਼ਾਦੀ ਹੈ ਉੱਥੇ ਵੀ ਭੰਗੜਾ ਪਾਇਆ ਜਾਂਦਾ ਖੁਸ਼ੀ ਜ਼ਾਹਰ ਕੀਤੀ ਜਾਂਦੀ ਹੈ ਬੋਲੀਆਂ ਪਾਈਆਂ ਜਾਂਦੀਆਂ ਨੇ ਪੰਜਾਬ ਲੋਕ ਗੀਤ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਨੇ ਅਤੇ ਭੰਗੜਾ ਪਾਇਆ ਜਾਂਦਾ ਹੈ